ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਬੋਲਣ ਦਾ ਵੱਖਰਾ ਤਰੀਕਾ ਹੈ ਅਤੇ ਲਿਖਣ ਦਾ ਵੱਖਰਾ ਤਰੀਕਾ ਹੈ ਜਦ ਪੰਜਾਬੀ ਜਿਹੜੀ ਭਾਸ਼ਾ ਏ ਉਹਨੂੰ ਲਿਖਣ ਲਈ ਗੁਰਮਿਤ ਲਿਪੀ ਦੁਆਰਾ ਲਿਖੀ ਜਾਂਦੀ ਹੈ ਅਤੇ ਪੰਜਾਬੀ ਭਾਸ਼ਾ ਬੋਲਣ ਲਈ ਪੰਜਾਬ ਦੇ ਹੀ ਵੱਖਰੇ ਵੱਖਰੇ ਖੇਤਰਾਂ ਵਿੱਚ ਉਨ੍ਹਾਂ ਦੀ ਉਪਭਾਸ਼ਾਵਾਂ ਦੁਆਰਾ ਬੋਲੀ ਜਾਂਦੀ ਹੈ ਜਿਵੇਂ ਕਿ ਪੰਜਾਬ ਵਿੱਚ ਚਾਰ ਤਰ੍ਹਾਂ ਦੀ ਭਾਸ਼ਾ ਬੋਲੀ ਜਾਂਦੀਆਂ ਹਨ ਜਿਵੇਂ ਪੁਆਧੀ ਮਲਵਈ ਦੁਆਬੀ ਮਾਝੀ ਇਹ ਚਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪੰਜਾਬ ਵਿੱਚ ਕਈ ਤਰ੍ਹਾਂ ਦੇ ਅਜਿਹੇ ਖੇਤਰ ਵੀ ਹਨ ਕਿ ਜਿਨ੍ਹਾਂ ਵਿੱਚ ਚਾਰ ਚਾਰ ਪੰਜ ਪੰਜ ਪਿੰਡ ਟੱਪ ਕੇ ਵੀ ਉਹਨਾਂ ਦੇ ਜਿਹੜੇ ਬੋਲਣ ਦਾ ਤਰੀਕਾ ਜਾਂ ਕੁਝ ਉਹਨਾਂ ਦੀ ਉਪਭਾਸ਼ਾਵਾਂ ਉਹ ਚੇਂਜ ਹੁੰਦੀਆਂ ਰਹਿੰਦੀਆਂ ਹਨ